ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਪ੍ਰਦੀਪ ਸਿੰਘ ਬੋਲਦੇ ਸਫਲ ਕਿਸਾਨ ਹੰਡਿਆਏ ਤੋਂ ਜੀ ਮੈਂ ਤੁਹਾਡਾ ਲੇਖ ਪੜ੍ਹਿਆ ਸੀ ਅਖਬਾਰ 'ਚ ਬਹੁਤ ਚਰਚਾ ਜੀ ਸੀ ਤੁਹਾਡੀ ਉਹ 'ਚ ਅਖਬਾਰ 'ਚ ਵੀ ਤੁਸੀਂ ਐਂ ਦੱਸੋ ਵੀ ਇਹਦਾ ਟਰਨਓਵਰ ਕਿੰਨਾ ਕੁ ਨਿਕਲ ਜਾਂਦਾ ਤੁਹਾਡਾ ਮਹੀਨੇ ਦਾ ਵੀ ਔਰਗੈਨਿਕ ਸਬਜ਼ੀਆਂ ਉਗਾ ਕੇ ਟਿਪਸ ਵੀ ਦਿਓ ਵੀ ਮੈਨੂੰ ਪਹਿਲਾਂ ਤੁਸੀਂ ਦੱਸੋ ਵੀ ਆਪਦੇ ਬਾਰੇ

ਹਾਂਜੀ

ਹਾਂਜੀ ਅੱਛਾ ਜੀ ਜੀ ਮੇਰੇ ਥੋੜ੍ਹੇ ਡਾਊਟ ਆ ਉਹ ਕਲੀਅਰ ਕਰੋ ਤੁਸੀਂ ਹਾਂਜੀ ਮੈਂ ਵੀ ਹੈ ਨਾ ਔਰਗੈਨਿਕ ਉਗਾਉਣਾ ਚਾਹੁੰਦਾ ਸਬਜ਼ੀ ਜਾਂਦੀ ਹੈ ਜੀ ਤੁਸੀਂ ਦੱਸੋ ਵੀ ਉਹਨੂੰ ਵੀ ਆਪਾਂ ਲੰਬੇ ਟਾਈਮ ਤੱਕ ਕਿਵੇਂ ਰੱਖ ਸਕਦੇ ਹਾਂ ਹਾਂਜੀ ਵਰਤਦਾ ਜੀ

ਅੱਛਾ ਜੀ ਹਾਂਜੀ ਠੀਕ ਹੈ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਅਸੀਂ ਵੀ ਟਰਾਈ ਕਰਦੇ ਹਾਂ ਹਾਂਜੀ ਹਾਂਜੀ ਜ਼ਰੂਰ ਧੰਨਵਾਦ ਜੀ